ਮੈਨੂੰ ਆਪਣੀ ਜ਼ਿੰਦਗੀ ਦਾ ਇੱਕ ਸਮਾਂ ਯਾਦ ਹੈ ਬਹੁਤ ਸਮਾਂ ਪਹਿਲਾਂ ਨਹੀਂ ਜਦੋਂ ਮੈਂ ਅਤੇ ਮੇਰਾ ਪਰਿਵਾਰ ਪਹਿਲੀ ਵਾਰ ਵਾਈਟ ਵਾਟਰ ਰਾਫਟਿੰਗ ਗਏ ਸੀ ਅਸੀਂ ਆਪਣੀਆਂ ਗਰਮੀ ਦੀਆਂ ਕੁਝ ਛੁੱਟੀਆਂ ਟੈਨਸੀ ਦੇ ਗੈਟਲਿਨਬਰਗ ਦੇ ਨੇੜੇ ਸਮੋਕੀ ਮਾਊਂਟੇਨਸ ਵਿੱਚ ਕੈਬਨ ਵਿੱਚ ਬਿਤਾ ਰਹੇ ਸੀ ਅਗਲੇ ਦਿਨ ਅਸੀਂ ਨਨਤਹਲਾ ਨਦੀ ਦੇ ਹੇਠਾਂ ਚੜ੍ਹਨ ਦੇ ਨਾਲ ਦੁਬਿਧਾ ਅਤੇ ਉਮੀਦ ਦੀ ਭਾਵਨਾ ਦੇ ਨਾਲ਼ ਸ਼ਾਨਦਾਰ ਉਤਸ਼ਾਹ ਦੀਆਂ ਭਾਵਨਾਵਾਂ ਦਾ ਅਨੁਭਵ ਕਰਨ ਕਰਾਂਗੇ ਮੈਨੂੰ ਸਾਡੇ ਆਲ਼ੇ ਦੁਆਲ਼ੇ ਦੇ ਨਜ਼ਾਰਿਆਂ ਨੂੰ ਵਿਸਤ੍ਰਿਤ ਵਿਸਤਾਰ ਨਾਲ ਯਾਦ ਹੈ ਜਦੋਂ ਅਸੀਂ ਨਨਟਾਹਲਾ ਤੋਂ ਹੇਠਾਂ ਆਪਣੀ ਖਤਰਨਾਕ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਅਸੀਂ ਅਗਲੇ ਦਿਨ ਤੜਕੇ ਦੁਪਹਿਰ ਨੂੰ ਡਰੋਅ ਪਾਕ ਪੁਆਇੰਟ 'ਤੇ ਪਹੁੰਚ ਗਏ ਤਾਜ਼ੇ ਪਾਈਨ ਦੇ ਦਰੱਖਤਾਂ ਦੀ ਮਿੱਠੀ ਮਹਿਕ ਹਵਾ ਵਿੱਚ ਤੈਰ ਰਹੀ ਸੀ ਅਤੇ ਗਰਮੀਆਂ ਦੀ ਮੱਧਮ ਹਵਾ ਸਾਡੇ ਚਿਹਰਿਆਂ 'ਤੇ ਬੁਰਸ਼ ਕਰ ਰਹੀ ਸੀ ਪ੍ਰਾਪਤ ਕਰਨ ਤੋਂ ਬਾਅਦ ਪਾਣੀ ਬਰਫੀਲਾ ਠੰਡਾ ਸੀ ਤੁਹਾਡੀ ਹੱਡੀ ਨੂੰ ਕੰਬਣ ਲਈ ਇੰਨਾ ਠੰਡਾ ਸੀ ਮੈਨੂੰ ਨਹੀਂ ਲੱਗਦਾ ਕਿ ਆਰਕਟਿਕ ਵਿੱਚ ਇੱਕ ਆਈਸਬਰਗ ਦੇ ਆਲ਼ੇ ਦੁਆਲ਼ੇ ਪਾਣੀ ਹੋਰ ਠੰਡਾ ਹੋ ਸਕਦਾ ਸੀ ਹਰ ਵਾਰ ਜਦੋਂ ਮੈਨੂੰ ਛਿੜਕਿਆ ਜਾਂਦਾ ਸੀ ਮੇਰੇ ਸਿਰ ਵਿੱਚ ਹਾਈਪੋਥਰਮੀਆ ਦੇ ਵਿਚਾਰ ਉੱਡ ਜਾਂਦੇ ਸਨ ਸਾਡਾ ਬੇੜਾ ਸਾਡੇ ਬੇੜੇ ਵਿੱਚ ਲਗਾਤਾਰ ਪਾਣੀ ਦੇ ਛਿੜਕਾਅ ਕਾਰਨ ਲਗਭਗ ਕੁਝ ਬਾੜ ਡੁੱਬ ਗਿਆ ਹਰ ਵਾਰ ਜਦੋਂ ਅਸੀਂ ਰੈਪਿਡਸ ਦੇ ਇੱਕ ਹਿੱਸੇ ਨੂੰ ਪਾਸ ਕਰਦੇ ਹਾਂ ਅਤੇ ਖਾਸ ਤੌਰ 'ਤੇ ਜਦੋਂ ਅਸੀਂ ਇੱਕ ਗਿਰਾਵਟ ਦੇ ਸਿਖਰ 'ਤੇ ਪਹੁੰਚ ਜਾਂਦੇ ਹਾਂ ਤਾਂ ਮੇਰੇ ਉੱਤੇ ਇੱਕ ਉਮੀਦ ਦੀ ਭਾਵਨਾ ਆ ਜਾਂਦੀ ਹੈ ਮੈਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਵੇਗਾ ਹਮੇਸ਼ਾ ਇੱਕ ਮੌਕਾ ਹੁੰਦਾ ਸੀ ਕਿ ਸਾਡਾ ਬੇੜਾ ਕਿਸੇ ਪੱਥਰ ਨਾਲ ਟਕਰਾ ਕੇ ਪਲਟ ਸਕਦਾ ਹੈ ਜਾਂ ਕੋਈ ਬਾਹਰ ਡਿੱਗ ਸਕਦਾ ਹੈ ਅਸੀਂ ਹਮੇਸ਼ਾ ਇਨ੍ਹਾਂ ਜਮਾਉ ਦਾਰ ਚਟਾਨਾਂ ਅਤੇ ਵਿਸ਼ਾਲ ਪੱਥਰਾਂ ਤੋਂ ਲੰਘਦੇ ਸੀ ਆਸਾਨੀ ਨਾਲ਼ ਸਾਡੇ ਬੇੜੇ ਨੂੰ ਪਲਟ ਸਕਦੇ ਸਨ ਜਾਂ ਸਾਨੂੰ ਫਸ ਸਕਦੇ ਸਨ